ਹਾਂਜੀ ਅਸੀਂ ਰਿਲੇਅ ਦੌੜ ਆ ਜਿਹੜੀ ਹਮੇਸ਼ਾ ਲਗਾਉਂਦੀ ਰਹਿੰਦੀ ਹਾਂ ਅਤੇ ਮੈਨੂੰ ਬਹੁਤ ਵਧੀਆ ਵੀ ਲੱਗਦਾ ਲਾਉਣ ਦੇ ਵਿੱਚ ਅਤੇ ਅ ਮੇਰਾ ਅਨੁਭਵ ਆ ਜਿਹੜਾ ਬਹੁਤ ਵਧੀਆ ਰਿਹਾ ਅਤੇ ਦੌੜ ਦੀ ਕੋਈ ਕੀਮਤ ਮਿਲਦੀ ਹਾਂ ਹਾਂਜੀ ਜਦੋਂ ਤੁਹਾਨੂੰ ਕੋਈ ਮੋਟੀਵੇਟ ਕਰਦਾ ਤੁਹਾਨੂੰ ਕੋਈ ਹੱਲਾਸ਼ੇਰੀ ਦਿੰਦਾ ਉਹ ਇਹਦੀ ਸਭ ਤੋਂ ਵੱਡੀ ਕੀਮਤ ਆ ਬਾਕੀ ਦੀਆਂ ਛੋਟੀਆਂ ਕੀਮਤਾਂ ਰਹਿ ਜਾਂਦੀਆਂ ਨੇ ਜਦੋਂ ਸਾਨੂੰ ਕੋਈ ਇਨਾਮ ਦੇ ਵਿੱਚ ਸਨਮਾਨਿਤ ਕੋਈ ਕਰਦਾ ਜਿਵੇਂ ਛੋਟੀ ਮੋਟੀ ਕੋਈ ਪ੍ਰਾਈਜ਼ ਸ਼ਾ ਸ਼ਾਬਾਸ਼ ਦਿੰਦਾ ਇਹੀ ਸਾਡੇ ਲਈ ਬਹੁਤ ਵੱਡੀ ਚੀਜ਼ ਆ ਅਤੇ ਜਿਹੜੀ ਰਿਲੇਅ ਦੌੜ ਹੈ ਇਹ ਮੈਨੂੰ ਹਮੇਸ਼ਾ ਸ਼ੁਰੂ ਤੋਂ ਹੀ ਵਧੀਆ ਲੱਗਦੀਆਂ ਸੀਗੀਆਂ ਅਤੇ ਮੈਂ ਹੁਣ ਵੀ ਮੇਰਾ ਦਿਲ ਕਰਦਾ ਹੁੰਦਾ ਇਹਨਾਂ 'ਚ ਪਾਰਟੀਸਪੇਟ ਕਰਾਂ ਮੇਰੀ ਇੰਨੀ ਏਜ ਹੋਣ ਦੇ ਨਾਤੇ ਮੈਂ ਹੁਣ ਵੀ ਇਹਦੇ 'ਚ ਪਾਰਟੀਸਪੇਟ ਕਰਦੀ ਹਾਂ ਅਤੇ ਅੱਗੇ ਆਪਣੀ ਟੀਮ ਨੂੰ ਜਿਹੜਾ ਹੋਰ ਵੀ ਜਿਆਦਾ ਪਾਰਟੀਸਪੇਟ ਕਰਨ ਦੀ ਹੱਲਾਸ਼ੇਰੀ ਦਿੰਦੇ ਰਹਿੰਦੇ ਹਾਂ ਅਤੇ ਅਤੇ ਜਿਹੜਾ ਇਹਦਾ ਐਕਸਪੀਰੀਅੰਸ ਆ ਉਹ ਬਹੁਤ ਹੀ ਵਧੀਆ ਹੁੰਦਾ